ਡਰਾਇੰਗ ਦੇ ਵਿੱਚ ਜੋ ਵੀ ਤਸਵੀਰ ਜਾਂ ਚਿੱਤਰ ਬਣਿਆ ਹੁੰਦਾ ਹੈ ਹਰੇਕ ਵਿਅਕਤੀ ਨੂੰ ਆਪਣੇ ਨਜ਼ਰੀਏ ਨਾਲ ਦੇਖਦਾ ਹੈ ਅਤੇ ਉਸਦੀ ਵਿਆਖਿਆ ਕਰਦਾ ਹੈ ਮੇਰਾ ਮੰਨਣਾ ਹੈ ਕਿ ਡਰਾਇੰਗ ਨੂੰ ਪਹਿਲਾਂ ਚੰਗੇ ਬਿਹਤਰ ਤਰੀਕੇ ਨਾਲ ਸਮਝਣਾ ਚਾਹੀਦਾ ਹੈ ਅਤੇ ਉਸਦੀ ਵਿਆਖਿਆ ਕਰਨੀ ਚਾਹੀਦੀ ਹੈ ਜੇਕਰ ਡਰਾਇੰਗ ਦੇ ਵਿੱਚ ਕੁਦਰਤੀ ਚੀਜ਼ ਬਣੀ ਹੈ ਤਾਂ ਉਹ ਆਪਣੇ ਅਨਕੂਲਣ ਦਾ ਪ੍ਰਤੀਕ ਹੈ ਜੋ ਕਿ ਕੁਦਰਤ ਨੂੰ ਦਰਸਾਉਂਦੀ ਹੈ